ਨਾਗਰਿਕਾਂ ਦੀ ਸੁਰੱਖਿਆ ਅਤੇ ਸਮਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਸਾਨੂੰ ਕਾਨੂੰਨ ਪ੍ਰਣਾਲੀ ਵਿੱਚ ਕੁਝ ਸੁਧਾਰ ਕੀਤੇ ਜਾਣੇ ਚਾਹੀਦੇ ਹਨ ਅੱਜ ਕੱਲ੍ਹ ਜਿਹੜੇ ਛੋਟੇ ਛੋਟੇ ਬੱਚੇ ਹਨ ਉਹ ਨਸ਼ਾ ਕਰਨ ਦੇ ਆਦੀ ਬਣ ਗਏ ਹਨ ਕਿਉਂਕਿ ਉਹ ਨਸ਼ਾ ਇਸ ਕਰਕੇ ਕਰਦੇ ਹਨ ਕਿਉਂਕਿ ਉਹਨਾਂ ਨੂੰ ਜਿਹੜੀਆਂ ਉਹ ਜਿਹੜੇ ਉਹਨਾਂ ਦੇ ਆ ਮਾਂ ਪਿਓ ਹੈ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਨਿਗਰਾਨੀ ਵਿੱਚ ਨਹੀਂ ਰੱਖਦੇ ਹਨ ਉਹਨਾਂ ਦੀਆਂ ਜ਼ਰੂਰਤਾਂ ਵੱਧ ਚੁੱਕੀਆਂ ਹੋਈਆਂ ਹਨ ਜਿਹਦੇ ਨਾਲ ਕਿ ਜਦੋਂ ਉਹਨਾਂ ਦੀ ਉਹ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਹਨ ਅਤੇ ਉਹ ਨਸ਼ਿਆਂ ਦੇ ਆਦੀ ਬਣ ਜਾਂਦੇ ਹਨ ਜਿਹਦੇ ਨਾਲ ਕਿ ਅੱਜ ਕੱਲ੍ਹ ਉਸ ਕਾਨੂੰਨ ਪ੍ਰਣਾਲੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਸਰਕਾਰ ਨੂੰ ਤਾਂ ਕਿ ਉਹ ਜਿਹੜੇ ਨਸ਼ੇ ਵੱਧ ਚੁੱਕੇ ਹਨ ਉਹਨਾਂ ਨਸ਼ਿਆਂ 'ਤੇ ਉਹਨਾਂ ਨੂੰ ਲਗਾਉਣਾ ਚਾਹੀਦਾ ਲਗਾਮ ਲਗਾਉਣੀ ਚਾਹੀਦੀ ਹੈ ਔਰ ਸਾਡੇ ਇੱਥੇ ਪੰਜਾਬ ਦੇ ਵਿੱਚ ਸਾਡੇ ਦੇਸ਼ ਵਿੱਚ ਵੱਧ ਰਹੇ ਅਪਰਾਧ ਵਿੱਚ ਇੱਕ ਇਹੋ ਜਿਹਾ ਅਪਰਾਧ ਹੈ ਜਿਹੜਾ ਕਈ ਲੋਕ ਜਿੱਦਾਂ ਕਿ ਲੋਕ ਲੋਕਾਂ ਨੂੰ ਨੌਕਰੀਆਂ ਦਾ ਝਾਂਸਾ ਦਿੰਦੇ ਹਨ ਨੌਕਰੀਆਂ ਦਾ ਝਾਂਸਾ ਦੇ ਕੇ ਉਹਨਾਂ ਨੂੰ ਕਈ ਵਾਰੀ ਓਨਲਾਈਨ ਫਰੋਡ ਬਹੁਤ ਜ਼ਿਆਦਾ ਓਨਲਾਈਨ ਜਿਹੜੇ ਹੈਗੇ ਆ ਉਹ ਵੱਧ ਚੁੱਕਿਆ ਹੋਇਆ ਜਿਹਦੇ ਨਾਲ ਕਿ ਕਈ ਵਾਰੀ ਨੌਕਰੀ ਕਹਿੰਦੇ ਕਿ ਤੁਹਾਨੂੰ ਤੁਸੀਂ ਇੰਨੇ ਪੈਸੇ ਪਾਓ ਅਤੇ ਤੁਹਾਨੂੰ ਇੱਦਾਂ ਨੌਕਰੀ ਮਿਲ ਜੇਗੀ ਇੱਕ ਵਾਰੀ ਮੇਰੇ ਨਾਲ ਵੀ ਇੱਦਾਂ ਹੀ ਹੋਇਆ ਕਿ ਮੇਰੇ ਇੱਕ ਮੁੰਡੇ ਨੂੰ ਕਿ ਓਨਲਾਈਨ ਫੇਸਬੁਕ ਵਿੱਚ ਜੋਬ ਲਈ ਓਫਰ ਆਈ ਉਹਨੇ ਔਰ ਉਹਨਾਂ ਦੀ ਤਕਨੀਕ ਅਪਣਾਈ ਅਤੇ ਉਹ ਕਹਿੰਦੇ ਸੀ ਤੁਸੀਂ ਸਾਡੇ ਵਿਚ ਇੰਨਾ ਪੈਸਾ ਪਾ ਦਿਉ ਅਤੇ ਅਸੀਂ ਤੁਹਾਨੂੰ ਲੈਪਟੋਪ ਭੇਜ ਦਾਂਗੇ ਜਦੋਂ ਉਹਨਾਂ ਨੇ ਸਾਨੂੰ ਲੈਪਟੋਪ ਵੀ ਨਹੀਂ ਭੇਜਿਆ ਫਿਰ ਅਸੀਂ ਦੇਖਿਆ ਫਿਰ ਉਹ ਕਹਿੰਦੇ ਫਿਰ ਤੁਸੀਂ ਇੰਨਾ ਪੈਸਾ ਪਾ ਦਿਉ ਤੁਹਾਡਾ ਹਵਾਈ ਜਹਾਜ ਰਾਹੀਂ ਲੈਪਟੋਪ ਆਉਂਦਾ ਪਿਆ ਹਨ ਜਿਹਦੇ ਨਾਲ ਸਾਡਾ ਇੰਨਾ ਕੁ ਪੈਸਾ ਖ਼ਤਮ ਹੋ ਗਿਆ ਜਿਹੜਾ ਅਸੀਂ ਸੋਚ ਵੀ ਨਹੀਂ ਸੀ ਸਕਦੇ ਇਸ ਕਰਕੇ ਸਾਡੇ ਦੇਸ਼ ਨੂੰ ਸਾਡੇ ਅੰਮ੍ਰਿਤਸਰ ਨੂੰ ਸਾਡੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਤੇ ਬਣਾਉਣ ਲਈ ਕਾਨੂੰਨ ਪ੍ਰਣਾਲੀ ਅਪਣਾਉਣੀ ਚਾਹੀਦੀਆਂ ਤਾਂ ਕਿ ਜੇ ਆਮ ਲੋਕ ਜਿਹੜੇ ਹੈ ਕਿ ਉਹ ਜਾਂਦੇ ਹੀ ਨਹੀਂ ਹੈ ਪੁਲਿਸ ਕੋਲ ਕਿ ਸਾਡੇ ਨਾਲ ਇਹ ਕੁਛ ਹੋ ਚੁੱਕਾ ਹੈ ਮੈਂ ਵੀ ਨਹੀਂ ਗਈ ਕਿਉਂਕਿ ਮੈਂ ਵੀ ਮੇਰੇ ਨਾਲ ਵੀ ਜੋ ਕੁਛ ਹੋਇਆ ਮੈਂ ਸਰਕਾ ਪੁਲਿਸ ਕੋਲ ਗਈ ਨਹੀਂ ਕਿਉਂਕਿ ਜੇ ਅਸੀਂ ਪੁਲਿਸ ਕੋ ਜਾਂਦੇ ਹਾਂ ਅਤੇ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਜੇ ਆ ਲੋਕ ਆਉਂਦੇ ਹਨ ਜਿਹੜੇ ਜ਼ਰੂਰਤਮੰਦ ਜਿਹੜੇ ਜਿਨ੍ਹਾਂ ਨਾਲ ਫਰੋਡ ਹੋ ਚੁੱਕਾ ਹੋਇਆ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੇ ਬਣਾਇਆ ਜਾਵੇ ਉਹਨਾਂ ਨਾਲ ਉਹਨਾਂ ਨਾਲ ਚੰਗੀ ਤਰ੍ਹਾਂ ਸਾਂਭ ਨਾ ਕਰਨ ਨਹੀਂ ਉਹਨਾਂ ਨੂੰ ਕਿਹਾ ਜਾਵੇ ਕਿ ਅਸੀਂ ਤੁਹਾਡੇ ਬਿਲਕੁਲ ਨਾਲ ਹਨ ਇਸ ਕਰਕੇ ਕਈ ਲੋਕ ਤਾਂ ਡਰਦੇ ਮਾਰੇ ਵੀ ਨਹੀਂ ਜਾਂਦੇ ਹਨ ਪੁਲਿਸ ਕਿਉਂਕਿ ਬਾਅਦ 'ਚੋਂ ਇਹਨਾਂ ਲੋਕਾਂ ਨੇ ਰਿਸ਼ਵਤ ਦੇ ਕੇ ਛੁੱਟ ਜਾਣਾ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦਾ ਸਾਥ ਦੇਣ ਤਾਂ ਕਿ ਇਹ ਜਿਹੜੇ ਕਾਨੂੰਨਾਂ ਨੂੰ ਲੋਕ ਚੰਗੀ ਤਰ੍ਹਾਂ ਆਪਣੇ ਸਮਝ